ਗਾਇਕੀ ਦਾ ਸ਼ੌਂਕ ਮੈਨੂੰ ਬਚਪਨ ਤੋਂ ਸੀ ਅਤੇ ਮੈਂ ਬਹੁਤ ਸੋਹਣਾ ਸ਼ੁਰੂ ਤੋਂ ਹੀ ਗਾਉਂਦਾ ਰਿਹਾ ਹਾਂ ਅਤੇ ਪਰ ਮੈਂ ਪਹਿਲਾਂ ਸਾਡੇ ਕਲਾਸ ਵਿੱਚ ਬੱਚੇ ਥੋੜ੍ਹੇ ਹੁੰਦੇ ਸੀ ਅਤੇ ਹੁਣ ਮੈਂ ਉਹਨਾਂ ਗਾੜੀ ਹੀ ਗਾਉਂਦਾ ਰਿਹਾ ਫੇਰ ਮੈਂ ਜਿਸ ਟੈਮ ਕਾਲਜ ਵਿੱਚ ਗਿਆ ਉੱਥੇ ਵੀ ਸਾਡਾ ਚਲੋ ਕੋਈ ਨਾ ਕੋਈ ਪ੍ਰੋਗਰਾਮ ਛੋਟਾ ਚੱਲਣਾ ਅਤੇ ਉਹਦੇ ਵਿੱਚ ਮੈਂ ਭਾਗ ਲੈਣਾ ਇੱਕ ਦਿਨ ਕੀ ਹੋਇਆ ਕਿ ਮੈਂ ਸਾਡੇ ਕੌਲਜ ਵਿੱਚ ਵੱਡਾ ਫੈਕਸ਼ਨ ਰੱਖਿਆ ਹੋਇਆ ਸੀ ਉਸ ਵਿੱਚ ਵੀ ਸਾਡੇ ਟੀਚਰਾਂ ਨੇ ਮੇਰਾ ਨਾਮ ਪਾ ਤਾ ਜਦ ਮੈਂ ਉਸ ਟਾਈਮ ਸਟੇਟ 'ਤੇ ਗਿਆ ਅਤੇ ਮੈਂ ਦੇਖ ਕੇ ਅਤੇ ਮੈਂ ਥੋੜ੍ਹਾ ਜਿਹਾ ਘਬਰਾ ਗਿਆ ਭਈ ਮੈਂ ਐਡੀ ਵੱਡੀ ਸਟੇਟ ਤੋਂ ਪਹਿਲੀ ਵਾਰ ਗਾਉਣ ਲੱਗਾ ਸਾਂ ਅਤੇ ਮੈਂ ਉਹ ਜੱਦ ਗਾਉਣਾ ਸ਼ੁਰੂ ਕੀਤਾ ਅਤੇ ਮੈਂ ਉਹਨਾਂ ਨਾਲ ਆਪਣੀਆਂ ਸਾਰੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਮੈਂ ਸ਼ੁਰੂ ਤੋਂ ਕਿਸ ਤਰ੍ਹਾਂ ਗਾਉਂਦਾ ਰਿਹਾ ਹਾਂ ਅਤੇ ਪਰ ਮੈਨੂੰ ਉਸ ਦੇ ਨਾਲ ਬਹੁਤ ਵਧੀਆ ਅਨੁਭਵ ਹੋਇਆ ਅਤੇ ਸਾਰੇ ਹੀ ਮੇਰੀਆਂ ਸੰਗੀਤ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਅਤੇ ਸਾਰਿਆਂ ਨੇ ਮੈਨੂੰ ਬਹੁਤ ਪਸੰਦ ਕੀਤਾ